ਹੈਲੋ ਮੈਂ ਭਾਰਤ ਦੇ ਪੰਜਾਬ ਰਾਜ ਦੀ ਰਹਿਣ ਵਾਲੀ ਹਾਂ ਅਤੇ ਇੱਥੋਂ ਦੇ ਭੋਜਨ ਬਾਰੇ ਗੱਲ ਕਰੀਏ ਤਾਂ ਸਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਸਪੈਸ਼ਲ ਹੈ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਜਿਹੜੀ ਹੈਗੀ ਉਹ ਲੋਕਾਂ ਦੀ ਬਹੁਤ ਮਨਪਸੰਦ ਹੈ ਅਤੇ ਇਸ ਨੂੰ ਬਹੁਤ ਸ਼ੌਂਕ ਨਾਲ ਖਾਦਾ ਜਾਂਦਾ ਇਸ ਤੋਂ ਇਲਾਵਾ ਚਨੇ ਹੋ ਗਏ ਦਾਲ ਕੜੀ ਚਾਵਲ ਇਹ ਵੀ ਬਹੁਤ ਹੀ ਸ਼ੌਂਕ ਨਾਲ ਖਾਦੇ ਜਾਂਦੇ ਆ ਅਤੇ ਲੱਸੀ ਹੋ ਗਈ ਲੱਸੀ ਘਰਾਂ 'ਚ ਬਣਾ ਕੇ ਅਤੇ ਬਹੁਤ ਹੀ ਸ਼ੌਂਕ ਨਾਲ ਪੀਤੀ ਜਾਂਦੀ ਹੈ ਇਹਨਾਂ ਦੇ ਵਿੱਚ ਜਿਹੜੇ ਮਸਾਲੇ ਆ ਉਹ ਪਾਏ ਜਾਂਦੇ ਹੈਗੇ ਆ ਜਿਵੇਂ ਹੋ ਗਏ ਕਾਲੀ ਮਿਰਚ ਹੋ ਗਈ ਧਨੀਆ ਹੋ ਗਿਆ ਜੀਰਾ ਇਹ ਸੁਆਦ ਬਣਾਉਣ ਲਈ ਮਸਾਲੇ ਜਿਹੜੇ ਘਰਾਂ 'ਚ ਹੀ ਬਣਾ ਕੇ ਪੀਸੇ ਜਾਂਦੇ ਪੀਸੇ ਜਾਂਦੇ ਘਰਾਂ 'ਚ ਹੀ ਤਿਆਰ ਕੀਤੇ ਜਾਂਦੇ ਹਨ ਬਾਹਰੋਂ ਬਜ਼ਾਰੀ ਜਿਹੜੇ ਮਸਾਲੇ ਪੀਸੇ ਹੁੰਦੇ ਆ ਉਹਨਾਂ 'ਚ ਬਹੁਤ ਮਿਲਾਵਟ ਹੁੰਦੀ ਹੈ ਇਸ ਲਈ ਲੋਕ ਘਰਾਂ 'ਚ ਹੀ ਬਣਾ ਕੇ ਮਸਾਲੇ ਜਿਹੜੇ ਪੀਸ ਕੇ ਉਹ ਤਿਆਰ ਕਰਦੇ ਆ ਸਬਜ਼ੀ ਦਾ ਸੁਆਦ ਬਣਾਉਣ ਲਈ ਹੋਰ ਜ਼ਿਆਦਾ ਇਸ ਤੋਂ ਇਲਾਵਾ ਇਹਦੇ ਵਿੱਚ ਸਬਜ਼ੀ ਵਿੱਚ ਕੜੀ ਪੱਤਾ ਹੋ ਗਿਆ ਹਿੰਗ ਹੋ ਗਈ ਉਹ ਵੀ ਮਿਕਸ ਕੀਤੇ ਜਾਂਦੇ ਆ ਜਿਸ ਨਾਲ ਹੋਰ ਵੀ ਭੋਜਨ ਦਾ ਸੁਆਦ ਵੱਧ ਜਾਂਦਾ ਹੈ ਅਤੇ ਪਰ ਅੱਜ ਕੱਲ੍ਹ ਜਿਸ ਤਰ੍ਹਾਂ ਹੋ ਗਿਆ ਇਹ ਫਾਸਟ ਫੂਡ ਲੋਕ ਖਾਣਾ ਪਸੰਦ ਕਰਨ ਜ਼ਿਆਦਾ ਹਨ ਫਾਸਟ ਫੂਡ ਨੂੰ ਪਹਿਲ ਦਿੰਦੇ ਆ ਜਿਸ ਤਰ੍ਹਾਂ ਪਹਿਲਾਂ ਵਾਲੀ ਜਿਸ ਤਰ੍ਹਾਂ ਸਾਗ ਸਰੋਂ ਦਾ ਅੱਜ ਵੀ ਮਨ ਪਸੰਦ ਆ ਪਰ ਜ਼ਿਆਦਾ ਹੁਣ ਫਾਸਟ ਫੂਡ ਵੱਲ ਵੀ ਰੁਝਾਨ ਹੋ ਗਿਆ ਲੋਕਾਂ ਦਾ ਹਾਂਜੀ ਓਕੇ